ਹੈਲੋ ਹਾਂਜੀ ਠੀਕ ਹੈ ਜੀ ਵਧੀਆ ਹੋਰ ਤੁਸੀਂ ਦੱਸੋ ਹਾਂਜੀ ਹਾਂਜੀ ਹਾਂਜੀ ਪਰਿਵਾਰ ਆਪਣਾ ਠੀਕ ਹੈ ਹੋਰ ਤੁਸੀਂ ਦੱਸੋ ਆਪਣਾ ਪਰਿਵਾਰ ਠੀਕ ਹੈ ਹਾਂਜੀ ਦੱਸੋ ਹਾਂਜੀ ਹਾਂਜੀ ਮੁਕਤਸਰ ਦੇ ਵਿੱਚ ਤਾਂ ਬਹੁਤ ਸਾਰੇ ਨੇਗੇ ਮੈਂ ਉਨ੍ਹਾਂ ਦੇ ਤੁਹਾਨੂੰ ਨਾਮ ਦੱਸ ਦਿੰਦੀ ਹਾਂ ਜਿਵੇਂ ਚਾਈਨਾ ਟਾਊਨ ਹੋ ਗਿਆ ਬਰਗਰ ਨਿਊਡਲਜ਼ ਮਨਚੂਰੀਅਨ ਪੱਪੂ ਸਮੋਸਿਆਂ ਵਾਲਾ ਭਵਾਨੀ ਸਵੀਟਸ ਅਤੇ ਗੋਰਾ ਗੁਲਸ਼ਨ ਪੈਟੀਜ਼ ਅਤੇ ਸ਼ਾਇਨਾ ਕੈਫੇ ਹੋ ਗਿਆ ਅਤੇ ਬੀਕਾਨੇਰ ਪਾਓ ਭਾਜੀ ਹੋ ਗਿਆ ਅਲੱਗ ਅਲੱਗ ਤਰ੍ਹਾਂ ਦੇ ਆਪਣੇ ਮੁਕਤਸਰ ਦੇ ਵਿੱਚ ਹੈ ਨਾ ਅਤੇ ਬਾਕੀ ਆਪਣੇ ਇੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਗਾ ਇਤਿਹਾਸਿਕ ਉੱਥੋਂ ਦਾ ਲੰਗਰ ਵੀ ਬਹੁਤ ਜ਼ਿਆਦਾ ਸਵਾਦ ਆ ਹੈਂਜੀ ਸਭ ਤੋਂ ਵੈਸੇ ਤਾਂ ਸਾਰਿਆਂ ਦੇ ਹੀ ਵਧੀਆ ਨੇ ਤੇ ਮੈਨੂੰ ਤਾਂ ਜ਼ਿਆਦਾਤਰ ਵੀ ਰਾਮ ਜੀ ਡੋਸਾ ਕਾਰਨਰ ਮਸੀਤ ਚੌਂਕ 'ਤੇ ਹੈਗਾ ਅਤੇ ਇਹ ਹੀ ਵਧੀਆ ਲੱਗਦਾ ਗਾ ਹਾਂਜੀ ਸਾਰੇ ਹੀ ਵਧੀਆ ਹੁੰਦੇ ਹੈਗੇ ਜ਼ਿਆਦਾ ਤਾਂ ਮੈਨੂੰ ਤਾਂ ਜਿਹੜਾ ਸਹੀ ਲੱਗਦਾ ਹੈ ਮੈਂ ਤਾਂ ਤੁਹਾਨੂੰ ਉਹ ਹੀ ਦੱਸਿਆ ਗਾ ਵੈਸੇ ਤਾਂ ਸਾਰਿਆਂ ਦਾ ਕੋਈ ਇੰਨਾ ਹੈ ਨਹੀਂ ਗਾ ਕੋਈ ਸਾਰੇ ਵਧੀਆ ਨਹੀਂ ਹੋਣਗੇ ਵੀ ਸਾਰੇ ਵਧੀਆ ਹੀ ਹੋਣਗੇ ਪਰ ਮੈਂ ਜਿਹੜੇ ਕੋਲ ਜਾਂਦੀ ਹਾਂ ਉਹ ਰਾਮ ਜੀ ਡੋਸਾ ਕੋਰਨਰ ਮਸੀਤ ਚੌਂਕ ਵਾਲੇ ਆ ਅਤੇ ਇੱਕ ਮੇਨ ਆਪਣੇ ਹੈਗਾ ਪੱਪੂ ਸਮੋਸਿਆਂ ਵਾਲਾ ਜ਼ਿਆਦਾ ਚੱਲਦਾ ਗਾ ਹਾਂਜੀ ਕੋਲ ਸਮੋਸੇ ਹੋ ਗਏ ਬ੍ਰੈਡ ਪਕੌੜੇ ਹੋ ਗਏ ਅਲੱਗ ਅਲੱਗ ਤਰ੍ਹਾਂ ਦੇ ਸਪਰਿੰਗ ਰੋਲ ਹੋ ਗਏ ਅਤੇ ਸੈਂਡਵਿਚ ਮਿਲਣ ਲੱਗ ਗਏ ਅੱਜ ਕੱਲ੍ਹ ਹਾਂ ਅਤੇ ਅਲੱਗ ਅਲੱਗ ਤਰ੍ਹਾਂ ਦੇ ਕਾਫ਼ੀ ਮਿਲਦੇ ਹੈਗੇ ਹਾਂ ਛੋਲੇ ਭਟੂਰੇ ਹੋ ਗਏ ਜਿਵੇਂ ਪੂਰੀਆਂ ਹੋ ਗਈਆਂ ਹਾਂ ਬਰਗਰ ਵਗੈਰਾ ਅਤੇ ਪਰੌਠੇ ਹੋ ਗਏ ਆਲੂਆਂ ਵਾਲੇ ਜਿਹੜੇ ਵੀ ਤੁਸੀਂ ਮਤਲਬ ਕਿ ਖਾਣਾ ਚਹੁੰਦੇ ਹੋ ਅਲੱਗ ਅਲੱਗ ਤਰ੍ਹਾਂ ਦੀ ਵਰੈਟੀ ਮਿਲ ਜਾਂਦੀ ਹੈ ਉੱਥੇ ਹਾਂਜੀ ਬਾਕੀ ਤੁਸੀਂ ਕੇ ਤੁਹਾਨੂੰ ਹਾਂਜੀ ਹਾਂਜੀ ਬਾਕੀ ਤੁਹਾਨੂੰ ਜ ਸਾਰਿਆਂ ਨਾਲੋਂ ਜ਼ਿਆਦਾ ਕਿਹੜਾ ਵਧੀਆ ਲੱਗੇ ਜਿਹੜੇ ਵੀ ਮੈਂ ਨਾਮ ਦੱਸੇ ਸੀ ਤੁਹਾਨੂੰ ਹਾਂਜੀ ਇਹ ਹੀ ਜ਼ਿਆਦਾ ਬੈਟਰ ਆ ਗਾ ਕਿਉਂਕਿ ਜ਼ਿਆਦਾਤਰ ਹਾਂਜੀ ਹਾਂਜੀ ਕੋਈ ਗੱਲ ਨਹੀਂ ਤੁਸੀਂ ਟ੍ਰਾਈ ਕਰ ਲਿਓ ਜੀ ਓਕੇ